ਹੈਲੋ ਸਰ ਮੈਂ ਮਤਲਬ ਕਿ ਅੰਮ੍ਰਿਤਸਰ ਤੋਂ ਬੋਲਦੀ ਹਾਂ ਮੈਨੂੰ ਅੰਮ੍ਰਿਤਸਰ ਤੋਂ ਕਸਬੇ ਤੱਕ ਜਾਣਾ ਸੀਗਾ ਪਿੰਡ ਅਤੇ ਉਥੋਂ ਦੀਆਂ ਸੇਵਾਵਾਂ ਮੈਨੂੰ ਪਤਾ ਨਹੀਂ ਆ ਕਿ ਕਿਹੜੀਆਂ ਕਿਹੜੀਆਂ ਵਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਉੱਥੋਂ ਦੇ ਜਾਣ ਲਈ ਕਾਰ ਜਾਂ ਕੋਈ ਕੈਬ ਜਾਂ ਬਸ ਕਿੰਨਾ ਕੁ ਟਾਈਮ ਲਗਾਉਂਦੀ ਆ ਪਹੁੰਚਾਣ 'ਚ ਅਤੇ ਕਿੰਨੇ ਪੈਸੇ ਆ ਉਹਦਾ ਸਾਰਾ ਹਿਸਾਬ ਕਿਤਾਬ ਮੈਨੂੰ ਦੱਸ ਦੋ ਅਤੇ ਮੈਨੂੰ ਜ਼ਰੂਰੀ ਜਾਣਾ ਕਿਸੇ ਕੰਮ ਜਿਹਦੇ ਨਾਲ ਮੈਨੂੰ ਟਾਈਮ ਜ਼ਿਆਦਾ ਮਤਲਬ ਕਿ ਨਾ ਲੱਗੇ ਥੋੜ੍ਹਾ ਘੱਟ ਲੱਗੇ ਕਿਉਂਕਿ ਮੈਂ ਜਲਦੀ ਪਹੁੰਚਣਾ ਚਾਹੁੰਦੀ ਹਾਂ ਉੱਥੇ ਕਿਉਂਕਿ ਮੇਰਾ ਕੰਮ ਹੈਗਾ ਵਾ ਜ਼ਿਆਦਾ ਜ਼ਰੂਰੀ ਆ ਅਤੇ ਇੰਪੋਰਟੈਂਟ ਆ ਇਸ ਕਰਕੇ ਮੈਂ ਜਲਦੀ ਪਹੁੰਚਣਾ ਚਾਹੁੰਦੀ ਹਾਂ ਉੱਥੇ ਤਾਂ ਇਸ ਕਰਕੇ ਜਿਹੜੀ ਵੀ ਸੇਵਾਵਾਂ ਜਲਦੀ ਤੋਂ ਜਲਦੀ ਮੈਨੂੰ ਉੱਥੇ ਪਹੁੰਚਾ ਦੇਣ ਤਾਂ ਉਹ ਸੇਵਾਵਾਂ ਬਾਰੇ ਮੈਨੂੰ ਦੱਸ ਦਿਓ ਤੁਸੀਂ